ਮੈਂ ਆਪਣੇ ਜ਼ਿਲ੍ਹੇ ਤਰਨ ਤਾਰਨ ਦੇ ਲੋਕਾਂ ਦੇ ਰੋਜ਼ਾਨਾ ਦੇ ਆਧਾਰ 'ਤੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਗੱਲ ਕਰਾਂਗੀ ਸਾਡੇ ਜ਼ਿਲ੍ਹੇ ਦੇ ਵਿੱਚ ਗੰਦਗੀ ਇੱਕ ਵੱਡੀ ਸਮੱਸਿਆ ਹੈ ਸੜਕਾਂ ਦੇ ਉੱਤੇ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ ਸਭ ਤੋਂ ਜ਼ਿਆਦਾ ਤਾਂ ਉਸ ਦੇ ਵਿੱਚ ਪਲਾਸਟਿਕ ਦੇ ਲਿਫਾਫੇ ਹੁੰਦੇ ਹਨ ਜੋ ਕਿ ਕਾਫੀ ਲੰਬੇ ਸਮੇਂ ਤੱਕ ਨਸ਼ਟ ਨਹੀਂ ਹੁੰਦੇ ਜਿਹਦੇ ਨਾਲ ਹਵਾ ਵੀ ਪ੍ਰਦੂਸ਼ਿਤ ਹੁੰਦੀ ਹੈ ਹਵਾ ਪ੍ਰਦੂਸ਼ਿਤ ਹੋਣ ਦੇ ਕਾਰਨ ਜ਼ਿਲ੍ਹੇ ਦੇ ਨਿਵਾਸੀਆਂ ਦੀ ਸਿਹਤ 'ਤੇ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਹੈ ਜੇਕਰ ਸਾਡੇ ਜ਼ਿਲ੍ਹੇ ਦੇ ਲੋਕਾਂ ਦੀ ਸਿਹਤ ਹੀ ਤੰਦਰੁਸਤ ਨਹੀਂ ਰਹੇਗੀ ਤਾਂ ਸਾਡੇ ਜ਼ਿਲ੍ਹੇ ਦਾ ਵਿਕਾਸ ਨਹੀਂ ਹੋ ਸਕਦਾ ਬੱਚਿਆਂ ਵਿੱਚ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੇਖਣ ਨੂੰ ਮਿਲੀਆਂ ਹਨ ਜਿਵੇਂ ਕਿ ਖਾਂਸੀ ਬੁਖਾਰ ਸਰੀਰਿਕ ਤਵਚਾ ਦੀ ਪ੍ਰੋਬਲਮ ਕਾਫੀ ਹੱਦ ਤੱਕ ਪ੍ਰੋਬਲਮ ਵੇਖੀਆਂ ਗਈਆਂ ਹਨ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਸਫਾਈ ਅਭਿਆਨ ਚਾਲੂ ਹੋਣੇ ਚਾਹੀਦੇ ਹਨ ਮੈਂ ਆਪਣੇ ਸਤਿਕਾਰਯੋਗ ਲੀਡਰਾਂ ਨੂੰ ਇਹ ਬੇਨਤੀ ਕਰਨਾ ਚਾਹੂੰਗੀ ਇਹੀ ਮਦਦ ਮੰਗਦੇ ਹਾਂ ਅਸੀਂ ਕਿ ਸਾਡੇ ਸ਼ਹਿਰ ਦੇ ਵਿੱਚ ਸਫਾਈ ਦਾ ਅਭਿਆਨ ਚਾਲੂ ਕੀਤਾ ਜਾਵੇ ਤਾਂ ਜੋ ਸਾਫ ਅਤੇ ਸੁੰਦਰ ਵਾਤਾਵਰਨ ਲੋਕਾਂ ਨੂੰ ਮਿਲੇ ਹਵਾ ਵੀ ਸਾਫ ਮਿਲੇ ਜਿਸ ਕਰਕੇ ਉਹਨਾਂ ਨੂੰ ਤੰਦਰੁਸਤੀਆਂ ਵੀ ਮਿਲਣ ਤੰਦਰੁਸਤੀ ਦੇ ਨਾਲ ਹੀ ਸ਼ਹਿਰ ਦਾ ਵਿਕਾਸ ਹੋ ਸਕਦਾ ਹੈ ਲੋਕ ਤੰਦਰੁਸਤ ਰਹਿਣਗੇ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ ਦਾ ਵੀ ਵਿਕਾਸ ਹੁੰਦਾ ਹੈ ਮੈਂ ਆਪਣੇ ਜ਼ਿਲ੍ਹਾ ਨਿਵਾਸੀਆਂ ਦੀ ਇਹੀ ਸਮੱਸਿਆਵਾਂ ਨੂੰ ਆਪਣੇ ਲੀਡਰਾਂ ਦੇ ਸਾਹਮਣੇ ਰੱਖਣਾ ਚਾਹੂੰਗੀ